ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਖੇਡਾਂ ਖੇਡਣ 'ਚ ਬਹੁਤ ਅੰਤਰ ਆ ਜਿਵੇਂ ਮੰਨ ਕੇ ਚੱਲੋ ਪਿੰਡਾਂ ਦੇ ਵਿੱਚ ਬਹੁਤ ਵੱਡੇ ਵੱਡੇ ਗਰਾਉਂਡ ਆ ਖੁੱਲ੍ਹੇ ਖੁੱਲ੍ਹੇ ਗਰਾਊਂਡ ਆ ਜਿਵੇਂ ਖੁੱਲ੍ਹੇ ਗਰਾਊਂਡਾਂ ਵਿੱਚ ਕਬੱਡੀ ਖੇਡੀ ਜਾਂਦੀ ਆ ਫੁੱਟਬਾਲ ਦੇ ਵੱਡੇ ਵੱਡੇ ਗਰਾਉਂਡ ਆ ਅਤੇ ਪਿੰਡਾਂ ਦੇ ਵਿੱਚ ਬਹੁਤ ਹੀ ਖ ਖੁੱਲ੍ਹੇ ਮੈਦਾਨ ਆ ਵਧੀਆ ਬੱਚਿਆਂ ਦਾ ਭੱਜ ਦੌੜ ਕੇ ਵਿਕਾਸ ਹੁੰਦਾ ਸਰੀਰਕ ਫਿਟਨੈਸ ਵਧੀਆ ਰਹਿੰਦੀ ਆ ਪਿੰਡਾਂ ਵਾਲੇ ਜਿਹੜੇ ਗਰਾਊਂਡਾਂ ਦੇ ਵਿੱਚ ਆ ਕੱਚੇ ਮੈਦਾਨ ਆ ਵਧੀਆ ਭੱਜਣ ਦੇ ਲਈ ਆ ਅਤੇ ਸ਼ਹਿਰਾਂ ਦੇ ਵਿੱਚ ਜਿਵੇਂ ਸ਼ਹਿਰਾਂ ਦੇ ਵਿੱਚ ਬਹੁਤ ਘੱਟ ਗਰਾਊਂਡ ਹੁੰਦੇ ਆ ਬਹੁਤ ਹੀ ਥੋੜ੍ਹੀਆਂ ਜਗ੍ਹਾ 'ਤੇ ਸ਼ਹਿਰਾਂ ਦੇ ਵਿੱਚ ਜ਼ਿਆਦਾਤਰ ਗੇਮਾਂ ਜਿਵੇਂ ਮੋਬਾਈਲਾਂ 'ਤੇ ਰਹਿ ਗਈਆਂ ਅੱਜ ਕੱਲ੍ਹ ਲੂਡੋ ਲਾ ਲਉ ਚੈਸ ਲਾ ਲਉ ਜਿਵੇਂ ਹੈ ਨਾ ਜਿਸ ਨਾਲ ਬੱਚਿਆਂ ਦਾ ਕੀ ਆ ਸਰੀਰਕ ਵਿਕਾਸ ਨਹੀਂ ਹੁੰਦਾ ਅਤੇ ਬੱਚੇ ਹਲਕੇ ਦੁਬਲੇ ਰਹਿ ਜਾਂਦੇ ਆ ਅਤੇ ਸ਼ਹਿਰਾਂ ਦੇ ਵਿੱਚ ਇਸ ਲਈ ਗਰਾਊਂਡਾਂ ਦੀ ਬਹੁਤ ਘਾਟ ਆ ਵੀ ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ ਖ ਬੱਚਿਆਂ ਨੂੰ ਖੇਡਣ ਲਈ ਅਤੇ ਪਿੰਡਾਂ ਦੇ ਵਿੱਚ ਤਾਂ ਵਧੀਆ ਵੀ ਖੁੱਲ੍ਹਾ ਮਾਹੌਲ ਆ ਵੱਡੇ ਵੱਡੇ ਗਰਾਊਂਡ ਆ ਹੈ ਨਾ ਅਤੇ ਜਿਵੇਂ ਬੱਚਿਆਂ ਦੀ ਸਰੀਰਿਕ ਫਿਟਨੈਸ ਵਧੀਆ ਰਹਿੰਦੀ ਆ ਅਤੇ